ਇਤਿਹਾਸ ਵਿੱਚ ਕਈ ਪ੍ਰਥਾ ਅਤੇ ਰੀਤੀ ਰਿਵਾਜ਼ ਨੇ ਜਿਨ੍ਹਾਂ ਨੂੰ ਲੈ ਕੇ ਮੈਂ ਕੁਝ ਕੁ 'ਤੇ ਇਹ ਤਾਂ ਆਪਣਾ ਚਾਨਣਾ ਪਾਉਣਾ ਚਾਹੁੰਦੀ ਹਾਂ ਜਿਸ ਤਰ੍ਹਾਂ ਕਿ ਔਰਤ ਦੀ ਸਿੱਖਿਆ ਔਰਤ ਦੀ ਸਿੱਖਿਆ ਪਹਿਲਾਂ ਪਹਿਲੇ ਦੇ ਸਮੇਂ ਵਿੱਚ ਔਰਤਾਂ ਨੂੰ ਪੜ੍ਹਨ ਨਹੀਂ ਸੀ ਦਿ ਕੁੜੀਆਂ ਨੂੰ ਪੜ੍ਹਨ ਨਹੀਂ ਸੀ ਦਿੱਤਾ ਜਾਂਦਾ ਉਹਨਾਂ ਨੂੰ ਕਹਿੰਦੇ ਸਨ ਕਿ ਤੁਸੀਂ ਘਰ ਦਾ ਹੀ ਕੰਮ ਕਰਨਾ ਪੜ੍ਹ ਕੇ ਕੀ ਕਰਨਾ ਹੈ ਪਰ ਅੱਜ ਦੇ ਸਮੇਂ ਵਿੱਚ ਲੜਕੀਆਂ ਅਤੇ ਲੜਕਿਆਂ ਵਿੱਚ ਕੋਈ ਮੱਤਭੇਦ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਬਰਾਬਰ ਸਿੱਖਿਆ ਦਿੱਤੀ ਜਾਂਦੀ ਹੈ ਉਹ ਅੱਜ ਕੱਲ੍ਹ ਦੀਆਂ ਕੁੜੀਆਂ ਨੇ ਮੁੰਡਿਆਂ ਨਾਲੋਂ ਜ਼ਿਆਦਾ ਮੱਲਾਂ ਮਾਰੀਆਂ ਨੇ ਸਾਨੂੰ ਸਾਰਿਆਂ ਨੂੰ ਇੱਕੋ ਬਰਾਬਰ ਸਮਝਣਾ ਚਾਹੀਦਾ ਹੈ ਕੁੜੀ ਅਤੇ ਮੁੰਡਿਆਂ ਵਿੱਚ ਕੋਈ ਭੇਦ ਭਾਵ ਨਹੀਂ ਕਰਨਾ ਚਾਹੀਦਾ ਸਤੀ ਪ੍ਰਥਾ ਸਤੀ ਪ੍ਰਥਾ ਵਿੱਚ ਪਹਿਲੇ ਸਮੇਂ ਵਿੱਚ ਜਦ ਕਿਸੇ ਔਰਤ ਦਾ ਘਰਵਾਲਾ ਮਰ ਜਾਂਦਾ ਸੀ ਤਾਂ ਉਸਨੂੰ ਜਲਦ ਬਲਦੀ ਅ ਚਿਖਾ ਦੇ ਉੱਪਰ ਜਿੰਦੀ ਨੂੰ ਰੱਖ ਕੇ ਸਤ ਜਿੰਦੀ ਨੂੰ ਰੱਖ ਕੇ ਸਾੜ ਦਿੱਤਾ ਜਾਂਦਾ ਸੀ ਜਿਸ ਨੂੰ ਸਤੀ ਪ੍ਰਥਾ ਕਿਹਾ ਜਾਂਦਾ ਸੀ ਪਰ ਅੱਜ ਦੇ ਸਮੇਂ ਵਿੱਚ ਇਹ ਪ੍ਰਥਾ ਖ਼ਤਮ ਹੋ ਗਈ ਹੈ ਸਮੇਂ ਦੇ ਹਿਸਾਬ ਨਾਲ਼ ਬਹੁਤ ਕੁਛ ਅੱਗੇ ਵੱਧ ਚੁੱਕਿਆ ਹੈ ਇਸ ਲਈ ਸਾਨੂੰ ਅੱਜ ਦੇ ਸਮੇਂ ਦੇ ਹਿਸਾਬ ਨਾਲ਼ ਬਦਲਣਾ ਚਾਹੀਦਾ ਹੈ ਜੋ ਕਿ ਸਾਡੇ ਅਤੇ ਆਉਣ ਵਾਲੀ ਪੀੜ੍ਹੀ ਲਈ ਹੀ ਬਹੁਤ ਵਧੀਆ ਹੈ ਇਸ ਲਈ ਇਸ ਤੋਂ ਬਾਅਦ ਭਰੂਣ ਹੱਤ ਕੰਨਿਆ ਭਰੂਣ ਹੱਤਿਆ ਭਰੂਣ ਹੱਤਿਆ ਪਹਿਲੇ ਸਮੇਂ ਵਿੱਚ ਲੋਕ ਪਹਿਲਾਂ ਤਾਂ ਲੋਕ ਕੁੜੀਆਂ ਨੂੰ ਅ ਜੰਮਣ ਨਹੀਂ ਸੀ ਦਿੰਦੇ ਪਰ ਅੱਜ ਦੇ ਸਮੇਂ ਵਿੱਚ ਸਮਾਂ ਡਿਵੈਲਪ ਹੋ ਗਿਆ ਏ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਕੋਈ ਫ਼ਰਕ ਨਹੀਂ ਕੀਤਾ ਜਾਂਦਾ ਕੁੜੀਆਂ ਮੁੰਡੇ ਇੱਕ ਸਮਾਨ ਹਨ ਸਾਨੂੰ ਇਹ ਸੋਚ ਅਪਣਾਉਣੀ ਚਾਹੀਦੀ ਹੈ ਸਮੇਂ ਦੇ ਹਿਸਾਬ ਨਾਲ਼ ਚੱਲਣਾ ਚਾਹੀਦਾ ਹੈ ਤਾਂ ਜੋ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸੁਰੱਖਿਅਤ ਕਰ ਸਕੀਏ ਜੇ ਅੱਜ ਦੇ ਸਮੇਂ ਵਿੱਚ ਆਪਾਂ ਕੁੜੀਆਂ ਨੂੰ ਜੰਮਣ ਨਹੀਂ ਦੇਵਾਂਗੇ ਤਾਂ ਆਉਣ ਦੇ ਸਮੇਂ ਆਉਣ ਵਾਲੇ ਸਮੇਂ ਵਿੱਚ ਅਸੀਂ ਮੁੰਡਾ ਕਿੱਥੋਂ ਵਿਆਵਾਂਗੇ ਇਸ ਲਈ ਸਾਨੂੰ ਇਹ ਸਮੇਂ ਦੇ ਨਾਲ਼ ਚੱਲਣਾ ਚਾਹੀਦਾ ਹੈ ਤਾਂ ਜੋ ਅਸੀਂ ਅੱਗੇ ਵੱਧ ਸਕੀਏ